ਈਕਮਰਸ ਐਪ ਇੱਕ ਇਹੋ ਜਿਹਾ ਐਪ ਹੈ ਜਿਹਦੇ ਨਾਲ ਤੁਸੀਂ ਆਪਣੀ ਟਾਈਮ ਦੀ ਬਹੁਤ ਜ਼ਿਆਦਾ ਬੱਚਤ ਕਰ ਸਕਦੇ ਹੋ ਜਿਵੇਂ ਕਿ ਐਮਾਜ਼ੋਨ ਫਲਿਪਕਾਟ ਮਿਸ਼ੋ ਇੱਦਾਂ ਦੀ ਕਈ ਈਕਮਰਸ ਐਪ ਹੈ ਜਿਹਦੇ ਵਿੱਚ ਅਸੀਂ ਖਰੀਦਦਾਰੀ ਵੇਚਣਾ ਔਰ ਲੈਣਾ ਬਹੁਤ ਈ ਆਸਾਨ ਤਰੀਕੇ ਦੇ ਨਾਲ ਕਰ ਸਕਦੇ ਹਾਂ ਜਿਵੇਂ ਕਿ ਜਵੈਲਰੀ ਮੇਰਾ ਖੁਦ ਦਾ ਜਵੈਲਰੀ ਦਾ ਬਿਜਨਸ ਹੈ ਇਹਦੇ ਵਿੱਚ ਮੈਂ ਕਿੱਦਾਂ ਇਕ ਚੀਜ਼ ਨੂੰ ਵੇਚਣੀ ਹੈ ਅਤੇ ਇੱਕ ਚੀਜ਼ ਨੂੰ ਕਿੱਦਾਂ ਮੈਂ ਖਰੀਦਣੀ ਹੈ ਇਹ ਸਾਰੀ ਸਮਝ ਹੌ ਆਉਂਦੀ ਹੈ ਅਤੇ ਜਿਹੜੇ ਕਸਟਮਰ ਸਾਡੇ ਦੇ ਨਾਲ ਜੁੜਦੇ ਹਨ ਉਹਨਾਂ ਲਈ ਇਹ ਈਜ਼ੀ ਹੋ ਜਾਂਦਾ ਹੈ ਕਿ ਉਹਨਾਂ ਨੇ ਘਰ ਬੈਠੇ ਬੈਠੇ ਇਸ ਐਪ ਨੂੰ ਚਲਾ ਕੇ ਕਿੱਦਾਂ ਆਪਣੇ ਪ੍ਰੋਡਕਟ ਮੰਗਵਾਉਣੇ ਹੈ ਅਤੇ ਵੇਚਣੇ ਹੈ ਈਕਮਰਸ ਐਪ ਦੇ ਜ਼ਰੀਏ ਅਸੀਂ ਟਾਈਮ ਦੀ ਬੱਚਤ ਕਰ ਸਕਦੇ ਹਾਂ ਔਰਤਾਂ ਆਪਣੀ ਸ਼ੋਪਿੰਗ ਤੋਂ ਰਿਆਤ ਪਾ ਸਕਦੀਆਂ ਹੈ ਔਰ ਇਹ ਐਪ ਚਲਾ ਕੇ ਉਹ ਘਰ ਦੇ ਵਿੱਚ ਸਸਤੇ ਔਰ ਟਿਕਾਊ ਤਰੀਕੇ ਨਾਲ ਹਰ ਇੱਕ ਚੀਜ਼ ਖਰੀਦੀ ਅਤੇ ਵੇਚੀ ਦੀ ਜਾ ਸਕਦੀ ਹੈ ਅੱਜ ਕੱਲ੍ਹ ਦੀ ਪ੍ਰਕਿਰਿਆ ਦੇ ਵਿੱਚ ਈਕਮਰਸ ਐਪ ਦੀ ਵਰਤੋਂ ਲੋਕ ਜ਼ਿਆਦਾ ਤੋਂ ਜ਼ਿਆਦਾ ਕਰਨਾ ਪਸੰਦ ਕਰਦੇ ਹਨ ਇਹਦੇ ਨਾਲ ਇਹ ਇੱਕ ਸਾਨੂੰ ਆ ਆਸਾਨ ਤਰੀਕਾ ਬਣਾ ਦਿੱਤਾ ਜਾਂਦਾ ਹੈ ਕਿ ਅਸੀਂ ਘਰ ਬੈਠੇ ਬੈਠੇ ਕਿੱਦਾਂ ਇੱਕ ਚੀਜ਼ ਨੂੰ ਖਰੀਦਣੀ ਅਤੇ ਵਰਤਣੀ ਹੈ ਇਸ ਕਰਕੇ ਈਕਮਰਸ ਦੀ ਐਪ ਨੂੰ ਚਲਾਇਆ ਜਾਂਦਾ ਹੈ